ਹੈਲੋ ਹਾਂਜੀ ਐਕਚੁਲੀ ਸਾਨੂੰ ਤੁਹਾਡਾ ਨੰਬਰ ਪ੍ਰੋਵਾਈਡ ਹੋਇਆ ਸੀ ਅਸੀਂ ਇੱਥੇ ਨਿਊ ਰੈਜੀਡੈਂਟ ਪਟੇਲ ਨਗਰ ਵਾਲੀ ਸਾਈਡ ਤਾਂ ਤੁਸੀਂ ਉੱਧਰ ਹੀ ਰਹਿ ਰਹੇ ਹੋ ਨਾ ਹਾਂਜੀ ਐਕਚੁਅਲੀ ਅਸੀਂ ਪੁੱਛਣਾ ਸੀ ਕਿ ਅਸੀਂ ਇੱਥੇ ਨਿਊ ਘਰ ਲੈਣ ਲੱਗੇ ਸੀ ਅਸੀਂ ਪਹਿਲਾਂ ਬਠਿੰਡਾ ਰਹਿੰਦੇ ਸੀ ਹੁਣ ਅਸੀਂ ਇੱਥੇ ਸ਼ਿਫਟ ਕਰ ਰਹੇ ਹਾਂ ਤਾਂ ਇਹ ਚੀਜ਼ ਪੁੱਛਣੀ ਸੀ ਕਿ ਇੱਥੇ ਵੋਟਰ ਸਪਲਾਈ ਸਹੀ ਹੈ ਤੁਹਾਡੇ ਇੱਧਰ ਏਰੀਆ 'ਚ ਜਾਂ ਨਹੀਂ ਓਕੇ ਹੋਰ ਕੋਈ ਇਸ਼ੂ ਪਾਣੀ ਵਿੱਚ ਓਕੇ ਠੀਕ ਹੈ ਕੋਈ ਸੀਵਰੇਜ ਇਸ਼ੂ ਤਾਂ ਨਹੀਂ ਹੈਗਾ ਵੀ ਸੀਵਰੇਜ ਸੀਵਰੇਜ ਬਲੋਕ ਵਗੈਰਾ ਹੁੰਦੇ ਆ ਉਹ ਚੀਜ਼ਾਂ ਹੈਗੀਆਂ ਨੇ ਪਾਣੀ ਆਉਣ ਕਰਕੇ ਓਕੇ ਤਾਂ ਤੁਸੀਂ ਸਾਨੂੰ ਕੁਛ ਸਲਾਹ ਦੇ ਸਕਦੇ ਹੋ ਕਿ ਸਾਨੂੰ ਇੱਧਰ ਰਹਿਣਾ ਚਾਹੀਦਾ ਜਾਂ ਨਹੀਂ ਤੁਹਾਡੇ ਅਕੋਰਡਿੰਗ ਅੱਛਾ ਹੋਰ ਕੋਈ ਇਸ਼ੂ ਹੈ ਤਾਂ ਅਸੀਂ ਜੇ ਪੁੱਛਦੇ ਹਾਂ ਵੀ ਪਾਣੀ ਜਿਹੜਾ ਕਿ ਉਹ ਘਰ ਅੱਗੇ ਖੜ੍ਹ ਜਾਂਦਾ ਜਦੋਂ ਬਾਰਿਸ਼ ਵਗੈਰਾ ਕੋਈ ਇਸ਼ੂ ਆਉਂਦਾ ਉਦੋਂ ਵੀ ਠੀਕ ਹੈ ਤਾਂ ਇਹਦਾ ਕੋਈ ਸਲਿਊਸ਼ਨ ਕੀ ਹੈ ਬਾਅਦ ਵਿੱਚ ਤੁਹਾਨੂੰ ਕੀ ਕਰਨਾ ਪੈਂਦਾ ਠੀਕ ਹੈ ਅਤੇ ਇਹ ਮਤਲਬ ਇਹ ਪ੍ਰੋਬਲਮ ਕਦੋਂ ਤੋਂ ਚੱਲ ਰਹੀ ਤੁਹਾਡੇ ਇੱਧਰ ਏਰੀਆ 'ਚ ਹੁਣੇ ਜਾਂ ਸਟਾਟਿੰਗ ਤੋਂ ਹੀ ਐਵੇਂ ਆ ਓਕੇ ਤੁਸੀਂ ਇੱਥੇ ਕਦੋਂ ਤੋਂ ਰਹਿ ਰਹੇ ਹੋ ਓਕੇ ਓਕੇ ਠੀਕ ਹੈ ਚਲੋ ਠੀਕ ਹੈ ਓਕੇ ਥੈਂਕ ਯੂ